ਮੇਰਾ ਨਾਮ ਮਨਜੀਤ ਕੌਰ ਹੈ ਮੈਂ ਮੋਹਾਲੀ ਜ਼ਿਲ੍ਹੇ ਵਿੱਚ ਇੱਕ ਛੋਟੇ ਜਿਹੇ ਪਿੰਡ ਵਿੱਚ ਆਪਣੇ ਪਰਿਵਾਰ ਨਾਲ਼ ਰਹਿੰਦੀ ਹੈ ਮੈਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਹਾਂ ਮੈਂ ਧਾਰਮਿਕ ਖਿਆਲਾਂ ਦੀ ਹਾਂ ਮੈਂ ਗੁਰੂ ਘਰ ਰੋਜ਼ਾਨਾ ਜਾਂਦੀ ਹਾਂ ਮੈਂ ਸਿਲਾਈ ਕਢਾਈ ਦਾ ਕੰਮ ਵੀ ਕਰਦੀ ਹਾਂ ਇਸ ਦੇ ਨਾਲ਼ ਨਾਲ਼ ਮੈਂ ਆਪਣੇ ਪਿੰਡ ਦੀ ਭਲਾਈ ਲਈ ਕਈ ਤਰ੍ਹਾਂ ਦੇ ਵੱਖੋ ਵੱਖ ਕੰਮ ਕਰਦੀ ਰਹਿੰਦੀ ਹਾਂ